ਐਰੋਬਿਕਸ ਅਤੇ ਭੰਗੜਾ ਇਹ ਨਵੀਂ ਨੌਜਵਾਨਾਂ ਦੀ ਖੋਜ ਹੈ ਜਿਸ ਨੂੰ ਜੋੜ ਕੇ ਭੰਗੜੇ ਨੂੰ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਪੰਜਾਬ ਦੇ ਨੌਜਵਾਨਾਂ ਦਾ ਮੁਹਤਾਜ ਬਣਾ ਜਾ ਸਕੇ ਭੰਗੜਾ ਐਰੋਬਿਕਸ ਇੱਕ ਜੋਸ਼ੀਲਾ ਅਤੇ ਤੰਦਰੁਸਤ ਰੱਖਣ ਵਾਲਾ ਕਾਰਜ ਹੈ ਇਹ ਕਸਰਤ ਰੂਟੀਨ ਪੰਜਾਬ ਦੇ ਲੋਕ ਨਾਚ ਨੂੰ ਉਤਸ਼ਾਹ ਨਾਲ ਮਿਲਾਉਂਦੀ ਹੈ ਭੰਗੜਾ ਰਿਵਾਇਤੀ ਤੌਰ 'ਤੇ ਤਾਂ ਵਾਢੀ ਦੇ ਮੌਕੇ 'ਤੇ ਹੀ ਪਾਇਆ ਜਾਂਦਾ ਸੀ ਪਰੰਤੂ ਹੁਣ ਇਸ ਨੂੰ ਭੰਗੜਾ ਐਰੋਬਿਕਸ ਨਾਲ ਜੋੜ ਕੇ ਇੱਕ ਕਸਰਤ ਵਜੋਂ ਵੀ ਜਾਣਿਆ ਜਾਂਦਾ ਹੈ